ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਅੱਜ ਕੱਲ੍ਹ ਤੰਦਰੁਸਤ ਰਹਿਣਾ ਕਿੰਨਾ ਜ਼ਰੂਰੀ ਹੈ ਅਤੇ ਇਸ ਦੇ ਲਈ ਡਾਂਸ ਅਧਾਰਿਤ ਵਰਕਆਊਟ ਬਹੁਤ ਮਸ਼ਹੂਰ ਹੋ ਰਹੇ ਹਨ ਪਰ ਕੀ ਭੰਗੜਾ ਐਰੋਬਿਕਸ ਬਾਕੀ ਡਾਂਸ ਅਧਾਰਿਤ ਵਰਕਆਊਟ ਤੋਂ ਵੱਖਰਾ ਹੈ ਮੇਰਾ ਜਵਾਬ ਹੈ ਬਿਲਕੁਲ ਭੰਗੜਾ ਪੰਜਾਬ ਦਾ ਰਵਾਇਤੀ ਲੋਕ ਨਾਚ ਹੈ ਇਸ ਵਿੱਚ ਜੋਸ਼ ਊਰਜਾ ਅਤੇ ਤਾਕਤ ਹੈ ਜੋ ਇਸ ਨੂੰ ਇੱਕ ਸ਼ਾਨਦਾਰ ਵਰਕਆਊਟ ਬਣਾਉਂਦੇ ਹਨ ਹੋਰ ਡਾਂਸ ਫੋਰਮਾਂ ਵਿੱਚ ਤੁਹਾਨੂੰ ਸ਼ਾਇਦ ਇੱਕ ਖਾਸ ਤਰਤੀਬ ਜਾਂ ਸਟੈਪਸ ਨੂੰ ਫੋਲੋ ਕਰਨਾ ਪੈਂਦਾ ਹੈ ਪਰ ਭੰਗੜੇ ਵਿੱਚ ਤੁਸੀਂ ਆਪਣੀ ਊਰਜਾ ਅਤੇ ਜੋਸ਼ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹੋ ਇਸ ਵਿੱਚ ਢੋਲ ਦੀ ਤਾਲ ਅਤੇ ਊਰਜਾ ਭਰਪੂਰ ਸੰਗੀਤ ਤੁਹਾਨੂੰ ਹੋਰ ਵੀ ਉਤਸ਼ਾਹਿਤ ਕਰਦੇ ਹਨ ਭੰਗੜਾ ਐਰੋਬਿਕਸ ਸਿਰਫ ਸਰੀਰਿਕ ਤੰਦਰੁਸਤੀ ਹੀ ਨਹੀਂ ਸਗੋਂ ਮਾਨਸਿਕ ਤੰਦਰੁਸਤੀ ਲਈ ਵੀ ਬਹੁਤ ਵਧੀਆ ਇਹ ਤਣਾਅ ਨੂੰ ਘਟਾਉਂਦਾ ਹੈ ਮੂਡ ਨੂੰ ਵਧੀਆ ਕਰਦਾ ਅਤੇ ਤੁਹਾਨੂੰ ਖੁਸ਼ ਵੀ ਰੱਖਦਾ ਇਸ ਤੋਂ ਇਲਾਵਾ ਭੰਗੜਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਇਸ ਨੂੰ ਕਰਨ ਨਾਲ ਅਸੀਂ ਆਪਣੀ ਜੜ੍ਹਾਂ ਨਾਲ ਜੁੜੇ ਰਹਿੰਦੇ ਹਾਂ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਂਦੇ ਹਾਂ ਇਸ ਲਈ ਮੇਰੇ ਅਨੁਸਾਰ ਤਾਂ ਭੰਗੜਾ ਐਰੋਬਿਕਸ ਹੋਰ ਡਾਂਸ ਅਧਾਰਿਤ ਵਰਕਆਊਟ ਤੋਂ ਬਿਲਕੁਲ ਵੱਖਰਾ ਹੈ ਇਹ ਨਾ ਸਿਰਫ ਇੱਕ ਸ਼ਾਨਦਾਰ ਵਰਕਆਊਟ ਹੈ ਸਗੋਂ ਇਹ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਮਾਨਸਿਕ ਤੰਦਰੁਸਤੀ ਲਈ ਵੀ ਬਹੁਤ ਮਹੱਤਵਪੂਰਨ ਹੈ